ਵੀਹ ਫਰਵਰੀ ਦੋ ਹਜ਼ਾਰ ਚੌਦ੍ਹਾਂ ਸੱਤ ਜੁਲਾਈ ਉੱਨੀ ਸੌ ਬਿਆਸੀ ਦੋ ਫਰਵਰੀ ਦੋ ਹਜ਼ਾਰ ਦਸ ਇੱਕ ਦਸੰਬਰ ਦ ਉੱਨੀ ਸੌ ਅੱਸੀ ਅੱਠ ਜੁਲਾਈ ਉੱਨੀ ਸੌ ਪਚਾਨਵੇਂ